ਹਾਂਜੀ ਮੌਸਮ ਜਿਹੜੀਆਂ ਖਾਸ ਮੌਸਮ ਦੌਰਾਨ ਲੋਕਾਂ ਦੇ ਸਮੂਹ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ ਹਨ ਉਹ ਜਿਵੇਂ ਕਿ ਗਰਮੀਆਂ ਦੇ ਵਿੱਚ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਹੈ ਨਾ ਸਰਦੀਆਂ ਦੇ ਵਿੱਚ ਹੋ ਗਿਆ ਨਮੂਨੀਆ ਖੰਗ ਫਲੂ ਠੀਕ ਹੈ ਅਤੇ ਬਰਸਾਤਾਂ ਦੇ ਵਿੱਚ ਹੋ ਗਿਆ ਜਿੱਦਾਂ ਹੈਜਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਿਮਾਰੀਆਂ ਇਹ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ ਅਤੇ ਅਸੀਂ ਇਸ ਦੌਰਾਨ ਕੀ ਕਰਦੇ ਹਾਂ ਕਿ ਜਿੱਦਾਂ ਹੁਣ ਮੌਸਮ ਬਦਲਦਾ ਹੈ ਮੰਨ ਲਓ ਸਰਦੀਆਂ ਆਈਆਂ ਹੁਣ ਗਰਮੀ ਆਉਣੀ ਆ ਅਸੀਂ ਲੋਕਾਂ ਨੂੰ ਜਦੋ ਜ਼ਿਆਦਾ ਗਰਮੀ ਹੁੰਦੀ ਹੈ ਅਸੀਂ ਲੋਕਾਂ ਨੂੰ ਪਹਿਲਾਂ ਹੀ ਇਸ ਚੀਜ਼ ਤੋਂ ਜਾਣੂ ਕਰਾ ਦਿੰਦੇ ਜਾਂ ਉਹਨਾਂ ਨੂੰ ਜਾਣਕਾਰੀ ਅਵੇਅਰ ਕਰ ਦਿੰਦੇ ਹਾਂ ਕਿ ਗਰਮੀ ਬਹੁਤ ਆ ਰਹੀ ਹੈ ਅਤੇ ਤੁਸੀਂ ਆਪਣਾ ਬਚਾਅ ਹੈ ਨਾ ਕਿਵੇਂ ਕਰਨਾ ਉਹਨਾਂ ਦੇ ਬਚਾਅ ਦਾ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਵੱਧ ਤੋਂ ਵੱਧ ਪਾਣੀ ਪੀਓ ਠੀਕ ਆ ਜਾਂ ਆਪਣੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਆਪਣਾ ਮੂੰਹ ਸਿਰ ਕਵਰ ਜਿਹੜੇ ਹੈਗੇ ਆ ਉਹ ਚੰਗੀ ਤਰ੍ਹਾਂ ਢੱਕ ਕੇ ਨਿਕਲੋ ਅਤੇ ਜਿਵੇਂ ਬਰਸਾਤਾਂ ਦੇ ਮੌਸਮ ਵਿੱਚ ਹੈਜਾ ਹੋ ਜਾਂਦਾ ਹੈ ਅਸੀਂ ਲੋਕਾਂ ਨੂੰ ਇਹ ਦੱਸਦੇ ਹਾਂ ਕਿ ਹੈਜਾ ਤੋਂ ਬਚਣ ਲਈ ਤੁਸੀਂ ਜਿਹੜਾ ਆਪਣਾ ਪਾਣੀ ਹੈਗਾ ਉਹ ਚੰਗੀ ਤਰ੍ਹਾਂ ਉਬਾਲ ਕੇ ਪੀਓ ਡਾਇਰੈਕਟ ਪਾਣੀ ਨਾ ਪੀਓ ਸਾਫ ਪਾਣੀ ਪੀਓ ਓ ਆਰ ਐਸ ਦੀ ਅਸੀਂ ਲੋਕਾਂ ਨੂੰ ਵੰਡਦੇ ਹਾਂ ਜ਼ਿੰਕ ਦੀਆਂ ਗੋਲੀਆਂ ਵੰਡਦੇ ਹਾਂ ਤਾਂ ਕਿ ਜਿਹੜਾ ਇਹ ਹੈਜਾ ਜਿਹੜਾ ਹੈਗਾ ਉਹਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਸਰਦੀਆਂ ਦੇ ਵਿੱਚ ਅਕਸਰ ਜਿਹੜੀਆਂ ਹੋਣ ਵਾਲੀਆਂ ਫਲੂ ਜਿਵੇਂ ਕਿ ਇੱਕ ਤੋਂ ਦੂਜੇ ਤੋਂ ਹੁੰਦੀਆਂ ਹਨ ਉਹਦੇ ਵਿੱਚ ਜ਼ਿਆਦਾ ਅਸੀਂ ਇਲਾਜ ਜ਼ਿਆਦਾਤਰ ਕਰਦੇ ਹਾਂ ਕਿ ਲੋਕਾਂ ਨੂੰ ਕਹਿੰਦੇ ਹਾਂ ਕਿ ਭਾਫ ਵੱਧ ਤੋਂ ਵੱਧ ਲਓ ਮਾਸਕ ਪਾ ਕੇ ਰੱਖੋ ਤਾਂ ਕਿ ਘਰ ਦੇ ਵਿੱਚ ਕਿਸੇ ਹੋਰ ਨੂੰ ਬਿਮਾਰੀ ਨਾ ਹੋਏ ਠੀਕ ਹੈ ਇਸ ਕਰਕੇ ਇਹਨੂੰ ਉੱਥੇ ਹੀ ਰੋਕਿਆ ਜਾਵੇ ਅਤੇ ਅਕਸਰ ਉਹਨਾਂ ਨੂੰ ਆਪਾਂ ਜਿਹੜੀ ਹੈ ਦਵਾਈ ਉਹ ਦਿੰਦੇ ਹਾਂ ਲੋੜ ਅਨੁਸਾਰ ਦੇਖ ਕੇ ਕਿ ਹਾਂ ਜੋ ਵੀ ਉਹਦੀ ਕੰਡੀਸ਼ਨ ਹੈਗੀ ਹੈ ਉਹਦੇ ਅਨੁਸਾਰ ਅਸੀਂ ਉਹਨਾਂ ਨੂੰ ਦਵਾਈਆਂ ਦਿੰਦੇ ਹਾਂ